ਇੱਕ ਤਾਂ ਜੇ ਮੈਂ ਆਪਣੇ ਸਰਕਾਰ ਦੀ ਗੱਲ ਕਰਾਂ ਤਾਂ ਪੰਜਾਬ ਸਰਕਾਰ ਨੇ ਨਾ ਇੱਕ ਸਕੀਮ ਲਾਗੂ ਕੀਤੀ ਹੈ ਕਿ ਜਿਹਦੀ ਜਿਹੜੀ ਅ ਦੋ ਸੌ ਯੂਨਿਟ ਦੇ ਅੰਦਰ ਅੰਦਰ ਜੇ ਉਹ ਬਿਜਲੀ ਦੀ ਖ਼ਪਤ ਕਰੇਗਾ ਅਤੇ ਉਹਨਾਂ ਦੀ ਜਿਹੜੀ ਬਿਜਲੀ ਹੈਗੀ ਆ ਉਹ ਬਿਲਕੁਲ ਫਰੀ ਆਫ ਕੋਸਟ ਹੋਵੇਗੀ ਅਤੇ ਉਹਨਾਂ ਦਾ ਜਿਹੜਾ ਬਿੱਲ ਆ ਉਹ ਬਿਲਕੁਲ ਜ਼ੀਰੋ ਰੁਪੀਸ ਆਵੇਗਾ